ਵਈ ਗੱਲ ਇਹ ਹੈ ਤੂੰ ਸਾਨੂੰ ਲੇਟ ਕਰਤਾ ਤੇਰੇ ਲੇਟ ਆਉਣ ਕਾਰਨ ਔਰ ਤੇਰੇ ਸਲੋਅ ਵੈਨ ਜਾਂ ਜਿਹੜੀ ਤੇਰੀ ਗੱਡੀ ਹੈ ਉਹ ਨੂੰ ਸਲੋਅ ਚਲਾਉਣ ਕਾਰਨ ਅਸੀਂ ਟਰੇਨ ਪਕੜਨ ਤੋਂ ਵਾਂਝੇ ਰਹਿ ਗਏ ਔਰ ਇਸ ਦਾ ਖਮਿਆਜ਼ਾ ਜੋ ਹੈ ਇਸ ਦਾ ਜੋ ਨੁਕਸਾਨ ਹੈ ਉਹ ਅਸੀਂ ਨਹੀਂ ਹੁਣ ਭੁਗਤਣਾ ਇੱਕ ਤਾਂ ਸਾਡੀ ਟਰੇਨ ਦੇ ਟਿਕਟ ਦੇ ਪੈਸੇ ਉਹ ਵੀ ਤੈਨੂੰ ਦੇਣੇ ਪੈਣੇ ਆ ਔਰ ਤੈਨੂੰ ਅਸੀਂ ਇਸ ਦਾ ਕੋਈ ਕਿਰਾਇਆ ਵੀ ਨਹੀਂ ਦੇਣਾ ਕਿਉਂਕਿ ਤੇਰੇ ਕਾਰਨ ਸਾਨੂੰ ਜੋ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸਭ ਤੇਰੇ ਕਾਰਨ ਹੋਇਆ ਔਰ ਤੇਰੀ ਗੱਡੀ ਅਸੀਂ ਇਸ ਕਰਕੇ ਕਰੀ ਸੀ ਕਿ ਤੂੰ ਸਾਨੂੰ ਟਾਈਮ ਪਰ ਸਾਡੀ ਟਰੇਨ ਪਹੁੰਚਵਾਏਗਾ ਲੇਕਿਨ ਤੂੰ ਆਪੇ ਪਹਿਲਾਂ ਲੇਟ ਹੋ ਗਿਆ ਟਰੇਨ ਦਾ ਸਮਾਂ ਲੰਘ ਗਿਆ ਔਰ ਟਰੇਨ ਚਲੀ ਗਈ ਅਤੇ ਸਾਨੂੰ ਪ੍ਰੇਸ਼ਾਨੀ ਜੋ ਹੋ ਰਹੀ ਹੈ ਇਹਦਾ ਖਮਿਆਜ਼ਾ ਵੀ ਬਲਕਿ ਤੈਨੂੰ ਦੇਣਾ ਚਾਹੀਦਾ ਸਾਨੂੰ ਤਾਂ ਰਸਤੇ ਵਿੱਚ ਹੁਣ ਉਸ ਤੋਂ ਬਾਅਦ ਦੋ ਘੰਟੇ ਵੇਟ ਕਰਨੀ ਪੈਣੀ ਹੈ ਸਾਨੂੰ ਤਾਂ ਕਿਸੇ ਹੋਟਲ 'ਤੇ ਹੁਣ ਖਾਣਾ ਵੀ ਖਾਣਾ ਪੈਣਾ ਉਹਦਾ ਵੀ ਖਰਚਾ ਹੋਣਾ ਸਾਨੂੰ ਤਾਂ ਤੂੰ ਯਾਰ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਹੁਣ ਤੂੰ ਇਸ ਦਾ ਸਾਡਾ ਕਿਰਾਇਆ ਤਾਂ ਅਸੀਂ ਤੈਨੂੰ ਦੇਣਾ ਨਹੀਂ ਔਰ ਨਾ ਤੈਨੂੰ ਅਸੀਂ ਅੱਗੇ ਤੋਂ ਕੋਈ ਓਡਰ ਦਿੱਤਾ ਜਾਵੇਗਾ